ਭੰਗੜਾ ਇੱਕ ਬਹੁਤ ਅੱਛੀ ਚੀਜ਼ ਹੈ ਸਾਰਿਆਂ ਵਾਸਤੇ ਬੱਚਿਆਂ ਬੁੱਢਿਆਂ ਜਵਾਨਾਂ ਵਾਸਤੇ ਲੇਡੀਜ਼ ਵਾਸਤੇ ਵੀ ਸਭ ਇਹਦੇ 'ਚ ਪੂਰੀ ਐਕਸਰਸਾਈਜ਼ ਵੀ ਹੋ ਜਾਂਦੀ ਸਰੀਰ ਦੀ ਅਤੇ ਇਹਦੇ ਬੋਲੀਆਂ ਪਾ ਕੇ ਵੀ ਭੰਗੜਾ ਪੈ ਜਾਂਦਾ ਬੋਲੀਆਂ ਪਾਈਏ ਅਤੇ ਭੰਗੜਾ ਨਾਲ ਪਾਓ ਬਹੁਤ ਅੱਛਾ ਲੱਗਦਾ ਬਹੁਤ ਸੁੰਦਰ ਲੱਗਦਾ ਬੜਾ ਸਾਰੇ ਜਾਣੇ ਇਕੱਠੇ ਕਰਕੇ ਇਸ ਭੰਗੜੇ ਨੂੰ ਤੁਸੀਂ ਮਤਲਬ ਇੰਜੋਏ ਕਰੋ ਇਸ ਭੰਗੜੇ ਦਾ ਹੁਣ ਤਾਂ ਵਿਆਹਵਾਂ ਵਿੱਚ ਵੀ ਭੰਗੜੇ ਪੈਣ ਲੱਗ ਪਏ ਭੰਗੜੇ ਦੇ ਵਿੱਚ ਵਿਆਹ ਵਿਆਹਵਾਂ ਵਿੱਚ ਸਾਰੇ ਨੱਚਦੇ ਆ ਬਹੁਤ ਅੱਛਾ ਲੱਗਦਾ ਬੋਲੀਆਂ ਵੀ ਪੈਂਦੀਆਂ ਅਤੇ ਉਸ ਬਾਰੇ ਬਹੁਤ ਅੱਛਾ ਲੱਗਦਾ ਇਸ ਕਰਕੇ ਭੰਗੜਾ ਪਾਉਣਾ ਬਹੁਤ ਵਧੀਆ ਚੀਜ਼ ਹੈ ਐਕਸਰਸਾਈਜ਼ ਵੀ ਹੁੰਦੀ ਅਤੇ ਭੰਗੜੇ ਦੇ ਵਿੱਚ ਸਾਰੇ ਮ ਆਸ ਪੜੋਸ ਸਭ ਆਪਣਾ ਇੱਕ ਦੂਸਰੇ ਦੇ ਨਾਲ ਮਿਲ ਕੇ ਭੰਗੜਾ ਪਾਉਂਦੇ ਆ ਅਤੇ ਉਹਦੇ 'ਤੇ ਇੰਨਾ ਇੰਜੋਏ ਕਰਦੇ ਆ ਵੀ ਉਹ ਕਹਿੰਦੇ ਵੀ ਹੁਣ ਅਸੀਂ ਗੀਤਾਂ ਵਿੱਚ ਵੀ ਲੈ ਜਾਂਦੇ ਆ ਭੰਗੜੇ ਨੂੰ ਭੰਗੜੇ ਨੂੰ ਨੱਚਣ ਵਿੱਚ ਵੀ ਲੈ ਜਾਂਦੇ ਆ ਭੰਗੜੇ 'ਚ ਬੋਲੀਆਂ ਵੀ ਪੈਂਦੀਆਂ ਭੰਗੜੇ 'ਚ ਬੜਾ ਕੁਛ ਹੁੰਦਾ ਉਹਦੇ ਨਾਲ ਅਸੀਂ ਪ੍ਰੇਰਿਤ ਹੁੰਦੇ ਹਾਂ ਭੰਗੜਾ ਪਾਉਣ ਦੇ ਨਾਲ ਸਾਰੀਆਂ ਸਾਡੀ ਐਕਟੀਵਿਟੀਜ਼ ਜਿਹੜੀ ਹੈ ਉਹ ਮਤਲਬ ਆਪਣੇ ਸਰੀਰ ਦੀ ਸਾਰੀ ਹੋ ਜਾਂਦੀ ਹੈ ਜ਼ਰੂਰਤ ਹੀ ਨਹੀਂ ਪੈਂਦੀ ਕੋਈ ਪੁੱਛੇ ਨਾ ਹੋਵੇ ਬੜਾ ਆਨੰਦ ਆਉਂਦਾ ਵਿੱਚ ਭੰਗੜਾ ਪਾਉਣ 'ਚ ਥੈਂਕ ਯੂ ਜੀ